ਹਾਂਜੀ ਨਵਜੰਮੇ ਬੱਚੇ ਵਾਸਤੇ ਜਿਹੜੀਆਂ ਰਸਮਾਂ ਨੇ ਉਹ ਬੱਚਾ ਜੰਮਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਆਪੋ ਆਪਣੇ ਰੀਤੀ ਰਿਵਾਜ਼ ਹੁੰਦੇ ਹਨ ਜਿਵੇਂ ਸਾਡੇ ਵਿੱਚ ਇਹ ਰਿਵਾਜ਼ ਹੈ ਕਿ ਜਦੋਂ ਬੱਚੇ ਜੰਮਣ ਤੋਂ ਪਹਿਲਾਂ ਨੌਵੇਂ ਮਹੀਨੇ ਤੋਂ ਪਹਿਲਾਂ ਇੱਕ ਰੀਤ ਲੱਗਦੀ ਹੈ ਜੋ ਕਿ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਨਾਨਕਿਆਂ ਨੂੰ ਹੋਰ ਆਪਣੇ ਆਲੇ ਦੁਆਲੇ ਗੁਆਢੀਆਂ ਨੂੰ ਬੁਲਾ ਕੇ ਪੰਜੀਰੀ ਬਣਾਈ ਜਾਂਦੀ ਹੈ ਜਿਹਦੀ ਜਿਹਦਾ ਜਿਹੜੀ ਮਾਂ ਨੇ ਬੱਚਾ ਜੰਮਣਾ ਹੁੰਦਾ ਹੈ ਉਸ ਦੀ ਝੋਲੀ ਵਿੱਚ ਪੰਜੀਰੀ ਪਾਈ ਜਾਂਦੀ ਹੈ ਫਲ ਪਾਏ ਜਾਂਦੇ ਹਨ ਉਸ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ ਅਤੇ ਗੁਆਢੀਆਂ ਨੂੰ ਜਾਂ ਹੋਰ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਹਨ ਉਹਨਾਂ ਨੂੰ ਵੀ ਪੰਜੀਰੀ ਦਿੱਤੀ ਜਾਂਦੀ ਹੈ ਸ਼ਗਨ ਵਜੋਂ ਅਤੇ ਉਸ ਤੋਂ ਬਾਅਦ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਘਰ ਵੀ ਬੱਚੇ ਨੇ ਜਨਮ ਲਿਆ ਬੇਟੇ ਨੇ ਜਨਮ ਲਿਆ ਸ ਪਹਿਲਾਂ ਮੋਡਰਨ ਜ਼ਮਾਨਾ ਹੁੰਦਾ ਪਹਿਲਾਂ ਪੁਰਾਣੇ ਸਮੇਂ 'ਚ ਕੀ ਹੁੰਦਾ ਸੀ ਬੱਚੇ ਦੀ ਜਦੋਂ ਡਿਲੀਵਰੀ ਹੁੰਦੀ ਸੀ ਉਹ ਘਰ ਵਿੱਚ ਹੁੰਦੀ ਸੀ ਉਸ ਦਾਈ ਨੂੰ ਬੁਲਾਇਆ ਜਾਂਦਾ ਸੀ ਡਿਲੀਵਰੀ ਕਰਾਉਣ ਵਾਸਤੇ ਪਰ ਅੱਜ ਕੱਲ੍ਹ ਮੋਡਰਨ ਜ਼ਮਾਨਾ ਹੈ ਹੁਣ ਹੋਸਪਿਟਲ ਹਸਪਤਾਲਾਂ ਦੇ ਵਿੱਚ ਬੱਚੇ ਦੀ ਡਿਲੀਵਰੀ ਹੁੰਦੀ ਹੈ ਚਲੋ ਅਸੀਂ ਹਸਪਤਾਲ 'ਚ ਬੱਚੇ ਨੇ ਜਨਮ ਲਿਆ ਸਵੇਰੇ ਅੱਠ ਵਜੇ ਉਸ ਤੋਂ ਬਾਅਦ ਇੱਕ ਰਾ ਇੱਕ ਦਿਨ ਉਹਨਾਂ ਨੇ ਹਸਪਤਾਲਾਂ ਵਾਲਿਆਂ ਨੇ ਰੱਖਿਆ ਉੱਥੇ ਹੀ ਓ ਦੂਸਰੇ ਦਿਨ ਸਾਨੂੰ ਛੁੱਟੀ ਦਿੱਤੀ ਉਹ ਵੀ ਅ ਹਸਪਤਾਲ ਵਾਲੇ ਵੀ ਜਿਹੜੇ ਉੱਥੇ ਕਰਮਚਾਰੀ ਸੀ ਕੰਮ ਕਰਦੇ ਸੀ ਉਹ ਵੀ ਵਧਾਈ ਲੈਣ ਵਾਸਤੇ ਸਾਡੇ ਕੋਲ ਆ ਕੇ ਸਾਨੂੰ ਵਧਾਈ ਦਿਉ ਜੀ ਤੁਹਾਡੇ ਘਰ ਬੱਚੇ ਨੇ ਜਨਮ ਲਿਆ ਮੁੰਡੇ ਨੇ ਬੇਟੇ ਨੇ ਜਨਮ ਲਿਆ ਚਲੋ ਅਸੀਂ ਆਪਣੀ ਖੁਸ਼ੀ ਅਨੁਸਾਰ ਉਹ ਜਿੰਨਾ ਵੀ ਹੋ ਸਕਿਆ ਉਹਨਾਂ ਨੂੰ ਵਧਾਈ ਦਿੱਤੀ ਅਤੇ ਦੂਸਰੇ ਦਿਨ ਛੁੱਟੀ ਹੋ ਗਈ ਅਸੀਂ ਘਰ ਆ ਕੇ ਘਰ ਆਉਣ ਤੋਂ ਪਹਿਲਾਂ ਅਸੀਂ ਦਰਵਾਜ਼ੇ 'ਤੇ ਤੇਲ ਚੋਇਆ ਤੇਲ ਚੋਣ ਤੋਂ ਬਾਅਦ ਅਸੀਂ ਘਰ ਚਲੇ ਗਏ ਚਲੋ ਬਹੁਤ ਖੁਸ਼ੀ ਹੋਈ ਲੋਕਾਂ ਨੂੰ ਡੱਬੇ ਦਿੱਤੇ ਮਿਠਾਈਆਂ ਵੰਡੀਆਂ ਉਸ ਤੋਂ ਬਾਅਦ ਨਾਨਕਿਆਂ ਨੇ ਨਾਨਕੇ ਆਏ ਅਤੇ ਅਸੀਂ ਕੁੜੀ ਨੂੰ ਅੰਮ੍ਰਿਤ ਛਕਾਇਆ ਬੱਚੇ ਨੂੰ ਅੰਮ੍ਰਿਤ ਛਕਾਇਆ ਇਸ ਤੋਂ ਪਹਿਲਾਂ ਇੱਕ ਗੁੜ੍ਹਤੀ ਦਿੱਤੀ ਜਾਂਦੀ ਹੈ ਇਹ ਦੀ ਬਹੁਤ ਜ਼ਿਆਦਾ ਵੱਡੀ ਰਸਮ ਹੈ ਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਘਰ ਦਾ ਜੀ ਬੱਚੇ ਨੂੰ ਗੁੜ੍ਹਤੀ ਦਿੰਦਾ ਹੈ ਉਸ ਦਾ ਸੁਭਾਅ ਉਸ ਬੱਚੇ ਵਿੱਚ ਆ ਜਾਂਦਾ ਹੈ ਚਲੋ ਮੇਰੇ ਛੋਟੇ ਭਰਾ ਨੇ ਬੱਚੇ ਨੂੰ ਮੁੰਡੇ ਨੂੰ ਗੁੜ੍ਹਤੀ ਦਿੱਤੀ ਅਤੇ ਅਸੀਂ ਫਿਰ ਗੁਰਦੁਆਰਾ ਸਾਹਿਬ ਗਏ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਬੱਚੇ ਦੀ ਦਾਤ ਦਿੱਤੀ ਨਾ ਬੱਚੇ ਦੀ ਦਾਤ ਮਿਲੀ ਹੈ ਅਤੇ ਨਾਲੇ ਅਸੀਂ ਨਾਮਕਰਨ ਕਰਨਾ ਸੀਗਾ ਬੱਚੇ ਦਾ ਅਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਹੁਕਮਨਾਮਾ ਦੱਸਿਆ ਜਾਵੇ ਅਤੇ ਅਸੀਂ ਬੱਚੇ ਦਾ ਨਾਮਕਰਨ ਕਰਨਾ ਹੈ ਬਾਬਾ ਜੀ ਨੇ ਹੁਕਮਨਾਮਾ ਦੱਸਿਆ ਅਤੇ ਜੱਜੇ ਤੋਂ ਪਹਿਲਾ ਅੱਖਰ ਸ਼ੁਰੂ ਹੋਇਆ ਅਸੀਂ ਜਸਕੀਰਤ ਸਿੰਘ ਉਸਦਾ ਨਾਮ ਰੱਖਿਆ ਚਲੋ ਘਰ ਆ ਗਏ ਘਰ ਆ ਕੇ ਖੁਸ਼ੀ ਹੋਈ ਸਾਨੂੰ ਬਹੁਤ ਜ਼ਿਆਦਾ ਬੱਚੇ ਬੱਚੇ ਦੇ ਨਾਨਕੇ ਆਏ ਫਿਰ ਉਹਨਾਂ ਨੇ ਪੰਜੀਰੀ ਬਣਾ ਕੇ ਖਵਾਈ ਮਾਂ ਨੂੰ ਉਹਦੀ ਝੋਲੀ ਪਾਈ ਇਸ ਤਰ੍ਹਾਂ ਵੱਖ ਵੱਖ ਤੌਰ 'ਤੇ ਬਹੁਤ ਜ਼ਿਆਦਾ ਰਸਮਾਂ ਹੁੰਦੀਆਂ ਹਨ ਜੋ ਕਿ ਅਲੱਗ ਅਲੱਗ ਆਪੋ ਆਪਣੇ ਰੀਤੀ ਰਿਵਾਜ਼ ਹੁੰਦੇ ਹਨ ਇਹ ਸਨ ਸਾਡੀਆਂ ਰਸਮਾਂ ਜੀ